ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਸਿੰਘ ਬੋਲ ਰਿਹਾਂ ਮੈਂ ਤੁਹਾਡੀ ਕੰਪਨੀ ਤੋਂ ਇੱਕ ਕਲਰ ਟੀ ਵੀ ਜਿਹੜਾ ਹੈਗਾ ਉਹ ਮੰਗਵਾਇਆ ਸੀ ਜਿਹੜਾ ਕਿ ਬਿਲਕੁਲ ਮੇਰਾ ਬੜਾ ਜਿਹੜਾ ਤਜ਼ਰਬਾ ਹੈਗਾ ਬਹੁਤ ਚੰਗਾ ਨਹੀਂ ਰਿਹਾ ਭੈੜਾ ਰਿਹਾ ਹੈਗਾ ਕਿਉਂਕਿ ਉਹ ਤੁਹਾਡਾ ਜਿਹੜਾ ਟੀ ਵੀ ਹੈਗਾ ਉਹ ਮੇਰੀ ਉਮੀਦਾਂ 'ਤੇ ਪੂਰਾ ਖਰਾ ਹੀ ਨਹੀਂ ਉਤਰਿਆ ਨਾ ਉਹਦੀ ਸਕਰੀਨ ਜਦੋਂ ਅਸੀਂ ਉਹਨੂੰ ਚਲਾਉਂਦੇ ਹਾਂ ਔਨ ਕਰਦੇ ਹਾਂ ਪਹਿਲਾਂ ਤਾਂ ਕਈ ਵਾਰੀ ਔਨ ਹੁੰਦਾ ਟਾਈਮ ਲਾ ਦਿੰਦਾ ਜੇਕਰ ਔਨ ਹੁੰਦਾ ਤਾਂ ਉਹਦੇ ਉੱਤੇ ਲਾਈਨਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਹਦੀ ਜਿਹੜੀ ਕੁਆਲਿਟੀ ਹੈਗੀ ਆ ਸਕਰੀਨ ਦੀ ਬੜੀ ਪੂਅਰ ਹੈਗੀ ਹੈਗੀ ਏ ਅਤੇ ਮੈਨੂੰ ਜਿਹੜੇ ਆ ਕੇ ਮੇਰੇ ਨਾਲ਼ ਦੇ ਗੁਆਂਢੀ ਦੇਖਦੇ ਹਨ ਕਿ ਤੂੰ ਇੰਨੇ ਪੈਸੇ ਲਾਏ ਸਨ ਤੂੰ ਇੰਨੇ ਪੈਸੇ ਲਾ ਕੇ ਬਜ਼ਾਰ ਦੇ ਵਿੱਚ ਜਾ ਕੇ ਹੋਰ ਕੋਈ ਚੀਜ਼ ਲੈ ਆਉਂਦਾ ਇਹਦੇ ਮੁਕਾਬਲੇ ਚੀਜ਼ ਵੇਖ ਕੇ ਲੈ ਲੈਂਦਾ ਪ੍ਰੰਤੂ ਮੈਂ ਜਿਹੜਾ ਤੁਹਾਡਾ ਔਨਲਾਈਨ ਮੰਗਵਾਇਆ ਇਹ ਮੇਰਾ ਜਿਹੜਾ ਤਜ਼ਰਬਾ ਹੈਗਾ ਬੜਾ ਭੈੜਾ ਤਜ਼ਰਬਾ ਰਿਹਾ ਹੈਗਾ ਹੈਗਾ ਅਤੇ ਇਸ ਕਰਕੇ ਮੈਂ ਚਾਹੁੰਦਾ ਕਿ ਅਜਿਹੇ ਜਿਹੜੀ ਚੀਜ਼ਾਂ ਲੋਕਾਂ ਤੱਕ ਤੁਸੀਂ ਪਹੁੰਚ ਕਰ ਰਹੇ ਹੋ ਨ ਜਿਹੜੀ ਹੈ ਤੁਹਾਡਾ ਸੈਕਿੰਡ ਕਲਾਸ ਮਾਲ ਹੁੰਦਾ ਹੈਗਾ ਤੁਸੀਂ ਉਹ ਔਨਲਾਈਨ ਦੇ ਥਰੂ ਭੇਜ ਰਹੇ ਹੋ ਜਿਹੜਾ ਕਿ ਲੋਕਾਂ ਨਾਲ ਇੱਕ ਲੋਕਾਂ ਨਾਲ ਬੜਾ ਵੱਡਾ ਧੋਖਾ ਕਰ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਇਹੀ ਸੁਜੈਸਟ ਕਰਦਾਂ ਕਿ ਅਜਿਹੇ ਚੀਜ਼ਾਂ ਤੋਂ ਬਚਾ ਆਪਣੇ ਬਾਜ ਆ ਜਾਓ ਕਿਉਂਕਿ ਅਜਿਹੇ ਲੋਕਾਂ ਦੇ ਵਿੱਚ ਉਹ ਦਿਨ ਦੂਰ ਨਹੀਂ ਜਿਹੜੇ ਤੁਹਾਡੇ ਤੁਹਾਨੂੰ ਕੋਰਟ ਦੇ ਵਿੱਚ ਖੜ੍ਹਾ ਕਰ ਦੇਣਗੇ ਧੰਨਵਾਦ